ਮੈਂ ਘੁੰਮਣ ਫਿਰਨ ਦਾ ਬਹੁਤ ਸ਼ੌਕੀਨ ਹਾਂ ਅਤੇ ਹਾਈਕਿੰਗ ਅਤੇ ਟਰੈਕਿੰਗ ਵਿੱਚ ਨਕਸ਼ੇ ਅਤੇ ਕੰਪਾਸ ਨੇ ਮੇਰੀ ਮਦਦ ਕੀਤੀ ਜਦੋਂ ਮੈਂ ਹਾਈਕਿੰਗ ਲਈ ਗਿਆ ਤਾਂ ਨਵੀਂ ਜਗ੍ਹਾ ਨੂੰ ਸਮਝਣ ਦੇ ਲਈ ਨਕਸ਼ੇ ਦਾ ਸਹਾਰਾ ਲਿਆ ਜੋ ਕਿ ਅੱਜ ਕੱਲ੍ਹ ਹਰ ਇੱਕ ਫੋਨ ਵਿੱਚ ਗੂਗਲ ਮੈਪ ਦੇ ਨਾਮ 'ਤੇ ਮੌਜੂਦ ਹੈ ਜਿਸ ਵਿੱਚ ਕੋਈ ਵੀ ਹੋਟਲ ਰੈਸਟੋਰੈਂਟ ਲੱਭਣ ਵਿੱਚ ਆਸਾਨੀ ਹੁੰਦੀ ਹੈ ਕਮਪਾਸ ਵੀ ਅੱਜ ਕੱਲ੍ਹ ਹਰ ਇੱਕ ਫੋਨ ਵਿੱਚ ਐਪ ਦੇ ਤੌਰ 'ਤੇ ਮੌਜੂਦ ਹੈ ਜਿਸ ਵਿੱਚ ਆਪਾਂ ਦਿਸ਼ਾ ਦੇਖਣ ਲਈ ਵਰਤਦੇ ਹਾਂ ਇਹ ਦੋਵੇਂ ਚੀਜ਼ਾਂ ਅਣਜਾਣੀ ਜਗ੍ਹਾ ਵਿੱਚ ਵੀ ਕੰਮ ਆਉਂਦੀਆਂ ਹਨ ਮੈਂ ਇੱਕ ਵਾਰ ਪਹਾੜੀ ਇਲਾਕੇ ਵਿੱਚ ਘੁੰਮਣ ਲਈ ਗਿਆ ਅਤੇ ਕਿਸੇ ਨੇ ਮੈਨੂੰ ਪਸ਼ਚਿਮ ਦਿਸ਼ਾ ਦੱਸਿਆ ਅਤੇ ਮੈਨੂੰ ਪਤਾ ਨਹੀਂ ਚੱਲ ਰਿਹਾ ਸੀ ਅਤੇ ਮੈਂ ਕੰਪਾਸ ਦਾ ਸਹਾਰਾ ਲੈ ਕੇ ਆਪਣੀ ਮੰਜ਼ਿਲ 'ਤੇ ਪਹੁੰਚਿਆ